ਭੰਗੜਾ ਸਾਡੇ ਪੰਜਾਬ ਦਾ ਪ੍ਰਮੁੱਖ ਨਾਚ ਹੈ ਭੰਗੜਾ ਹਰ ਇੱਕ ਖੁਸ਼ੀ ਵਿੱਚ ਪਾਇਆ ਜਾਂਦਾ ਹੈ ਭੰਗੜਾ ਪਾਉਣ ਨਾਲ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਬਹੁਤ ਵਧੀਆ ਲੱਗਦਾ ਹੈ ਹਰ ਇੱਕ ਖੁਸ਼ੀ ਵਿੱਚ ਭੰਗੜਾ ਪਾਇਆ ਜਾਂਦਾ ਹੈ ਹਰ ਇੱਕ ਕੰਮ ਖੁਸ਼ੀ ਦਾ ਕੰਮ ਕਰਨ ਲਈ ਭੰਗੜਾ ਪਾਉਣ ਵਿੱਚ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਨਾਲ ਇਨ੍ਹਾਂ ਦਾ ਕੋਈ ਪਹਿਰਾਵਾ ਜਿਵੇਂ ਕਿ ਭੰਗੜਾ ਪਾਉਣ ਲਈ ਆਮ ਤੌਰ 'ਤੇ ਕੁੜਤਾ ਚਾਦਰਾ ਤੁਰਲੇ ਵਾਲੀ ਪੱਗ ਜੈਕਟ ਪਾਈ ਜਾਂਦੀ ਹੈ ਇਸ ਵਿੱਚ ਧਮਾਲ ਕੱਢੀ ਜੁੱਤੀ ਝੂਮਰ ਪਾਏ ਜਾਂਦੇ ਹਨ ਇਸ ਸਟੈਪ ਪੰਜਾਬੀਆਂ ਦੇ ਸੁਭਾਅ ਵਾਂਗ ਜ਼ੋਰ ਵਾਲੇ ਅਤੇ ਖੁੱਲ੍ਹੇ ਡੁੱਲੇ ਹਨ ਇਹ ਸਟੈਪ ਪੰਜਾਬੀਆਂ ਦੇ ਸੁਭਾਅ ਨੂੰ ਪੇਸ਼ ਕਰਦੇ ਹਨ ਭੰਗੜਾ ਪਾਉਣ ਵੇਲੇ ਕੈਂਠਾ ਵੀ ਪਾਇਆ ਜਾਂਦਾ ਹੈ ਅਤੇ ਉਹ ਬਹੁਤ ਸੁੰਦਰ ਦਿਖਾਈ ਦਿੰਦਾ ਹੈ ਭੰਗੜਾ ਪੰਜਾਬ ਦਾ ਮਸ਼ਹੂਰ ਨਾਚ ਹੈ ਹਰ ਖੁਸ਼ੀ ਦੇ ਮੌਕੇ ਭੰਗੜਾ ਜ਼ਰੂਰ ਪਾਇਆ ਜਾਂਦਾ ਹੈ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਭੰਗੜਾ ਨਾ ਪਾਇਆ ਜਾਵੇ ਭੰਗੜਾ ਪੰਜਾਬ ਦੇ ਕਿਸਾਨਾਂ ਵੱਲੋਂ ਫਸਲ ਪੱਕਣ ਦੀ ਖੁਸ਼ੀ ਵਿੱਚ ਵੀ ਵਿਸਾਖੀ ਦੇ ਤਿਉਹਾਰ 'ਤੇ ਪਾਇਆ ਜਾਂਦਾ ਹੈ ਭੰਗੜਾ ਪਾਉਣ ਨਾਲ ਸਾਡੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਭੰਗੜਾ ਹਰ ਇੱਕ ਖੁਸ਼ੀ ਨੂੰ ਦੁੱਗਣਾ ਚੋਗਣਾ ਕਰ ਦਿੰਦਾ ਹੈ ਇਕੱਲਾ ਹੁਣ ਭੰਗੜਾ ਪੰਜਾਬ ਵਿੱਚ ਨਹੀਂ ਬਾਹਰਲੇ ਦੇਸ਼ਾਂ ਵਿੱਚ ਵੀ ਮਸ਼ਹੂਰ ਹੋ ਚੁੱਕਿਆ ਹੈ ਭੰਗੜਾ ਗੱਭਰੂਆਂ ਦਾ ਨਾਚ ਜਦੋਂ ਕਿ ਗਿੱਧਾ ਮੁਟਿਆਰਾਂ ਦਾ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿਹਨਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ 'ਤੇ ਵਿਆਹ ਮੰਗਣੇ ਤਿਉਹਾਰਾਂ 'ਤੇ ਸ਼ਾਮਲ ਹਨ ਇਸ ਲਈ ਭੰਗੜਾ ਬਹੁਤ ਵਧੀਆ ਲੱਗਦਾ ਹੈ